ਪੰਜਾਬ ਨੂੰ ਗੁਰੂਆਂ ਪੀਰਾਂ ਦੇ ਧਰਤੀ ਵੀ ਕਿਹਾ ਜਾਂਦਾ ਹੈ ਕਹਿੰਦੇ ਹਨ ਪੰਜਾਬ ਦੇ ਹਰ ਥਾਂ ਉੱਤੇ ਇੱਕ ਪੀਰ ਦੇਵੀ ਦੇਵਤਿਆਂ ਦਾ ਵਾਸ ਹੈ ਅਸੀਂ ਜਿੱਥੇ ਵੀ ਜਾਂਦੇ ਹਾਂ ਸਾਨੂੰ ਕਿਤੇ ਨਾ ਕਿਤੇ ਗੁਰਦੁਆਰਾ ਮਸਜਿਦ ਦਰਗਾਹ ਕੋਈ ਨਾ ਕੋਈ ਦੇਵੀ ਦੇਵਤਾ ਦਾ ਸਥਾਨ ਮਿਲ ਹੀ ਜਾਂਦਾ ਹੈ ਇੱਥੋਂ ਦਾ ਸਭ ਤੋਂ ਪ੍ਰਸਿੱਧ ਗੁਰਦੁਆਰਾ ਜੋ ਕਿ ਅੰਮ੍ਰਿਤਸਰ ਵਿੱਚ ਹੈ ਉਹ ਹੈ ਸ਼੍ਰੀ ਹਰਿਮੰਦਰ ਸਾਹਿਬ ਜਿਸਨੂੰ ਆਪਾਂ ਦਰਬਾਰ ਸਾਹਿਬ ਵੀ ਕਹਿ ਦਿੰਦੇ ਹਾਂ ਉੱਥੋਂ ਦੂਰੋਂ ਦੂਰੋਂ ਲੋਕ ਆਉਂਦੇ ਹਨ ਅਤੇ ਆਪਣੀਆਂ ਮਨੋਕਾਮਨਾਵਾਂ ਨੂੰ ਪੂਰਾ ਕਰਦੇ ਹਨ ਇੱਥੇ ਹੀ ਇੱਕ ਹੋਰ ਬਹੁਤ ਪ੍ਰਸਿੱਧ ਗੁਰਦੁਆਰਾ ਹੈ ਜਿਸ ਦਾ ਨਾਮ ਹੈ ਗੋਇੰਦਵਾਲ ਸਾਹਿਬ ਉੱਥੇ ਦੀ ਇਹ ਮਾਨਤਾ ਹੈ ਕਿ ਉੱਥੋਂ ਦੀ ਜਦੋਂ ਵੀ ਕੋਈ ਇਸ਼ਨਾਨ ਕਰਦਾ ਹੈ ਤਾਂ ਉੱਥੋਂ ਦੀਆਂ ਪੌੜੀਆਂ 'ਤੇ ਹਰ ਇੱਕ ਪੌੜੀ 'ਤੇ ਪਾਠ ਕਰਕੇ ਥੱਲੇ ਸਰੋਵਰ ਵਿੱਚੋਂ ਪਾਠ ਇਸ਼ਨਾਨ ਕਰਕੇ ਆਉਂਦਾ ਹੈ ਅਤੇ ਉਸਦੀ ਚੁਰਾਸੀ ਲੱਖ ਜੂਨਾਂ ਖਤਮ ਹੋ ਜਾਂਦੀਆਂ ਹਨ ਅਤੇ ਸਾਨੂੰ ਪਤਾ ਹੈ ਕਿ ਇਨਸਾਨ ਨੂੰ ਕਿਸ ਤਰ੍ਹਾਂ ਚੁਰਾਸੀ ਲੱਖ ਜੂਨਾਂ ਤੋਂ ਬਾਅਦ ਬਹੁਤ ਮੁਸ਼ਕਿਲ ਨਾਲ ਇੱਕ ਇਨਸਾਨ ਦਾ ਜੀਵਨ ਮਿਲਿਆ ਹੈ ਅਤੇ ਉਸ ਦੇ ਨਾਲ ਆਪਾਂ ਇੱਕ ਪਰਮਾਤਮਾ ਦੇ ਨਾਮ ਨਾਲ ਹੀ ਆਪਾਂ ਇਸ ਚੁਰਾਸੀ ਜੂਨਾਂ ਨੂੰ ਪਾਰ ਕਰਕੇ ਆਪਾਂ ਉਸ ਪਰਮਾਤਮਾ ਦੇ ਵਿੱਚ ਫਿਰ ਤੋਂ ਵਲੀਨ ਹੋ ਸਕਦੇ ਹਾਂ ਇੱਥੇ ਹੀ ਇੱਕ ਸਭ ਤੋਂ ਪ੍ਰਸਿੱਧ ਮੰਦਰ ਵਾਲਮੀਕੀ ਮੰਦਰ ਹੈ ਜਿਸ ਨੂੰ ਰਾਮ ਤੀਰਥ ਕਿਹਾ ਜਾਂਦਾ ਹੈ ਉੱਥੇ ਭਗਵਾਨ ਸ਼੍ਰੀ ਵਾਲਮੀਕ ਜੀ ਦਾ ਹੀ ਬਹੁਤ ਸੁੰਦਰ ਪ੍ਰਤਿਮਾ ਹੈ ਜਿੱਥੇ ਕਿ ਉੱਥੋਂ ਦੀ ਇਹ ਕਹਾਣੀ ਹੈ ਕਿ ਇੱਥੇ ਸ਼੍ਰੀ ਰਾਮ ਚੰਦਰ ਜੀ ਦੇ ਬੇਟੇ ਲਵ ਅਤੇ ਕੁਸ਼ ਅਤੇ ਮਾਤਾ ਸੀਤਾ ਜੀ ਨੇ ਬਨਵਾਸ ਕੱਟਿਆ ਹੀ ਅਤੇ ਆਪਣਾ ਬਨਵਾਸ ਤੋਂ ਬਾਅਦ ਸਾਰਾ ਜੀਵਨ ਹੀ ਇੱਥੇ ਕੀਤਾ ਸੀ ਅਤੇ ਲਵ ਕੁਸ਼ ਨੂੰ ਸ਼ਿਕਸ਼ਾ ਅਤੇ ਆਪਣੇ ਸਸ਼ਤਰ ਵਿੱਦਿਆ ਵੀ ਵਾਲਮੀਕ ਜੀ ਨੇ ਇੱਥੇ ਹੀ ਦਿੱਤੀ ਸੀ ਇਸ ਤਰ੍ਹਾਂ ਹੀ ਸਾਡੇ ਇੱਥੇ ਬਹੁਤ ਸਾਰੇ ਗੁਰਦੁਆਰੇ ਮਸਜਿਦ ਦਰਗਾਹ ਹਨ ਅਤੇ ਹਰ ਇੱਕ ਲੱਗ ਅਲੱਗ ਅਲੱਗ ਜਗ੍ਹਾ ਹੈ ਅਲੱਗ ਅਲੱਗ ਦੇਵੀ ਦੇਵਤਾ ਹਨ ਪਰ ਹਰ ਇੱਕ ਦਾ ਇੱਕੋ ਹੀ ਮੰਤਵ ਹੈ ਕਿ ਇਸ ਪਰਮਾਤਮਾ ਦਾ ਨਾਮ ਜਪਣਾ ਅਤੇ ਉਹਨਾਂ ਦੇ ਚੀਜ਼ਾਂ ਉਹਨਾਂ ਦੇ ਅਸੂਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਿਆ ਕੇ ਆਪਣੇ ਜ਼ਿੰਦਗੀ ਨੂੰ ਵਧੀਆ ਬਣਾਉਣਾ ਅੰਤ ਵਿੱਚ ਸਭ ਕੁਛ ਇੱਥੇ ਹੀ ਰਹਿ ਜਾਂਦਾ ਹੈ ਪਰ ਅਗਰ ਅੱਗੇ ਦਰਗਾਹ ਜਾਂਦਾ ਹੈ ਅਤੇ ਉਹ ਸਿਰਫ ਇੱਕ ਰੱਬ ਦਾ ਨਾਮ ਹੀ ਹੈ ਅਤੇ ਸਾਨੂੰ ਸਭ ਜਗ੍ਹਾ ਇਹੋ ਹੀ ਸੁਣਨ ਨੂੰ ਮਿਲਦਾ ਹੈ ਅਤੇ ਇਹੋ ਹੀ ਸਿੱਖਣ ਨੂੰ ਮਿਲਦਾ ਹੈ ਕਿ ਉਸ ਪਰਮਾਤਮਾ ਉਹ ਸੱਚੇ ਪਿਤਾ ਵਾਹਿਗੁਰੂ ਦਾ ਹੀ ਨਾਮ ਜਪਣਾ ਹੈ ਅਤੇ ਆਪਣੀ ਜ਼ਿੰਦਗੀ ਨੂੰ ਸਫਲ ਕਰਨਾ ਹੈ